ਮੈਂ ਚੂੜੀਆਂ ਔਨਲਾਈਨ ਮੰਗਾਈਆਂ ਸੀ ਚੂੜੀਆਂ ਬਹੁਤ ਜ਼ਿਆਦਾ ਸੋਹਣੀਆਂ ਸੀ ਮੈਂ ਵਿਆਹ 'ਤੇ ਪਾ ਕੇ ਗਈ ਸੀ ਮੈਨੂੰ ਹਰ ਇੱਕ ਤੋਂ ਜਣਾ ਪੁੱਛ ਰਿਹਾ ਸੀ ਤੂੰ ਚੂੜੀਆਂ ਕਿੱਥੋਂ ਲਿਈਆਂ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਈਆ ਉਹ ਚੂੜੀਆਂ ਪਾਉਣ ਦੇ ਵਿੱਚ ਵੀ ਔਰ ਦਿੱਕਤ ਨਹੀਂ ਆਈ ਅਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ